ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ 'ਤੇ 'ਤੇ ਕਮੀਜ਼ ਚਾਦਰਾ ਕੈਂਠਾ 'ਤੇ ਪਾਇਆ ਜਾਂਦਾ ਹੈ ਪੈਰ ਵਿੱਚ ਜੁੱਤੀ ਅਤੇ ਹੱਥ ਵਿੱਚ ਡਾਂਗ ਘੁੰਗਰੂਆਂ ਵਾਲੀ ਡਾਂਗ ਪਕੜੀ ਜਾਂਦੀ ਹੈ ਲੜਕੀਆਂ ਸਲਵਾਰ ਸੂਟ ਦੁਪੱਟਾ ਪਾਉਂਦੀਆਂ ਹਨ